ਮੈਂ ਹੁਣ ਤੱਕ ਕਾਫ਼ੀ ਤਸਵੀਰਾਂ ਕਲਿੱਕ ਕੀਤੀਆਂ ਨੇ ਅਤੇ ਜ਼ਿਆਦਾਤਰ ਮੈਂ ਵਿਆਹਾਂ ਵਿੱਚ ਫੋਟੋਆਂ ਕਲਿੱਕ ਕਰਦਾ ਹਾਂ ਜਿਵੇਂ ਕਿ ਆਪਣੀਆਂ ਕਪਲ ਫੋਟੋਜ਼ ਹੋ ਗਈਆਂ ਅਤੇ ਬ੍ਰਾਈਡਲ ਦਾ ਸ਼ੂਟ ਹੋ ਗਿਆ ਆਮ ਤੌਰ 'ਤੇ ਅਸੀਂ ਸਵੇਰੇ ਮੌਰਨਿੰਗ ਟਾਈਮ ਜਦੋਂ ਬ੍ਰਾਈਡਲ ਰੈਡੀ ਹੁੰਦੀ ਹੈ ਅਸੀਂ ਉਹਦੇ ਪਾਰਲਰ 'ਤੇ ਜਾ ਕੇ ਅਸੀਂ ਉਹਦੀ ਫੋੋਟੋਜ਼ ਕਲਿੱਕ ਕਰਦੇ ਹਾਂ ਅਤੇ ਫਿਰ ਬਾਅਦ ਵਿੱਚ ਉਹਦਾ ਜਵੈਲਰੀ ਦਾ ਵੀ ਸ਼ੂਟ ਕਰਦੇ ਹਾਂ ਫਿਰ ਜਦੋਂ ਬ੍ਰਾਈਡਲ ਪੈਲਿਸ 'ਚ ਐਂਟਰ ਹੋ ਜਾਂਦੀ ਹੈ ਤਾਂ ਅਸੀਂ ਦੋਨਾਂ ਦੀਆਂ ਕ ਕਪਲ ਫੋਟੋਜ਼ ਕਰਦੇ ਹਾਂ ਅਤੇ ਉਹਨਾਂ ਦੀ ਫੈਮਿਲੀ ਫੋਟੋਜ਼ ਵੀ ਕਰਦੇ ਹਾਂ ਅਤੇ ਉਸ ਤੋਂ ਬਾਅਦ ਮੈਂ ਫੈਸ਼ਨ ਫੋਟੋਗ੍ਰਾਫ਼ੀ ਵੀ ਕਰਦਾ ਏ ਜਿਵੇਂ ਕਿ ਅੱਜ ਕੱਲ੍ਹ ਨਵੇਂ ਟ੍ਰੈਨਡ ਚੱਲ ਪਏ ਹਨ ਮੈਂ ਉਹਨਾਂ 'ਤੇ ਵੀ ਕਾਫ਼ੀ ਵਰਕ ਕਰ ਰਿਹਾ ਫੋਟੋਗ੍ਰਾਫ਼ੀ ਦੀਆਂ ਨਵੀਂ ਨਵੀਆਂ ਚੀਜ਼ਾਂ ਕਰ ਰਿਹਾਂ ਅਤੇ ਮੈਂ ਸਿੰਗਰਾਂ ਦੇ ਵੀ ਸ਼ੂਟ ਕਰਦਾ ਹਾਂ ਅਤੇ ਪੋਟਰ ਸ਼ੂਟ ਹੋ ਗਏ ਆਪਣਾ ਪੋਰਟਫੋਲੀਓ ਹੋ ਗਏ ਠੀਕ ਹੈ ਅਤੇ ਵੈਡਿੰਗ ਫੋਟੋਜ਼ ਹੋ ਗਈਆਂ ਪ੍ਰੀ ਵੈਡਿੰਗ ਫੋਟੋਜ਼ ਹੋ ਗਈਆਂ ਅਤੇ ਕਿਡਜ਼ ਸ਼ੂਟ ਹੋ ਗਿਆ ਬਰਥਡੇ ਸ਼ੂਟ ਹੋ ਗਿਆ ਮੈਕਸੀਮਮ ਆਲ ਸ਼ੂਟਸ ਜਿੰਨੇ ਵੀ ਫੋਟੋਗ੍ਰਾਫ਼ੀ ਰੀਲੇਟਿਵ ਫੋਟੋਜ਼ ਹੁੰਦੀਆਂ ਮੈਂ ਹੁਣ ਤੱਕ ਕਾਫ਼ੀ ਚੀਜ਼ਾਂ ਕੈਪਚਰ ਕਰ ਲਈਆਂ ਹਨ ਅਤੇ ਆਮ ਤੌਰ 'ਤੇ ਜ਼ਿਆਦਾਤਰ ਵਿਆਹ ਵਿੱਚ ਅਸੀਂ ਫੈਮਿਲੀ ਫੋਟੋਜ਼ ਬਹੁਤ ਜ਼ਿਆਦਾ ਕਰਦੇ ਹਾਂ ਕਿਉਂਕਿ ਲੋਕ ਉਹਨਾਂ ਨੂੰ ਪਸੰਦ ਕਰਦੇ ਆਂ ਕਿਉਂਕਿ ਹਰ ਕੋਈ ਬੰਦਾ ਆਪਣੀ ਫੈਮਿਲੀ ਦੇ ਨਾਲ਼ ਫੋਟੋ ਕਰਵਾ ਕੇ ਘਰ ਵਿੱਚ ਰੱਖਣੀ ਪਸੰਦ ਕਰਦਾ ਹੈ